ਸਤਿ ਸ਼੍ਰੀ ਅਕਾਲ ਜੀ ਤੁਸੀਂ ਕੈਬ ਟਰਾਂਸਪੋਰਟ ਏਜੰਸੀ ਤੋਂ ਬੋਲ ਰਹੇ ਹੋ ਅਸੀਂ ਤੁਹਾਨੂੰ ਤੁਹਾਡੇ ਡਰਾਈਵਰ ਬਾਰੇ ਸ਼ਿਕਾਇਤ ਕਰਨਾ ਚਾਹੁੰਦੇ ਹਾਂ ਕਿ ਤੁਹਾਡਾ ਡਰਾਈਵਰ ਇੰਨਾਂ ਨਿਕੰਮਾ ਇੰਨਾਂ ਗੰਦਾ ਨਾ ਉਹਨੇ ਸਾਫ਼ ਕੱਪੜੇ ਪਾਏ ਹੋਏ ਸੀ ਅਤੇ ਉਹਨੂੰ ਕੋਲਡ ਵੀ ਇੰਨਾਂ ਲੱਗਾ ਹੋਇਆ ਸੀ ਔਰ ਖਾਂਸੀ ਵੀ ਇੰਨੀ ਜ਼ਿਆਦਾ ਆ ਰਹੀ ਸੀ ਨਾ ਤਾਂ ਉਹਨੇ ਮਾਕਸ ਪਾਇਆ ਸੀ ਅਤੇ ਨਾ ਹੀ ਉਹਦੀਆਂ ਸੀਟਾਂ ਜਿਹੜੀਆਂ ਇੰਨੀਆਂ ਗੰਦੀਆਂ ਸੀ ਸਾਡਾ ਹੱਥ ਰੱਖਣ 'ਤੇ ਜੀ ਨਹੀਂ ਸੀ ਕਰ ਰਿਹਾ ਸ਼ਾਇਦ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਉਹਨੇ ਕੁਛ ਡਰਿੰਕ ਵੀ ਕੀਤੀ ਸੀ ਡਰਿੰਕ ਕਰਨ ਨਾਲ ਉਹਨੇ ਪਤਾ ਤਿੰਨ ਚਾਰ ਵਾਰੀ ਇੱਧਰ ਉੱਧਰ ਠੋਕਿਆ ਵੀ ਹੈ ਔਰ ਐਕਸੀਡੈਂਟ ਹੁੰਦਿਆਂ ਬਹੁਤ ਮੁਸ਼ਕਿਲ ਨਾਲ ਬਚੇ ਹਾਂ ਅਸੀਂ ਪਲੀਜ਼ ਅਗਰ ਤੁਸੀਂ ਡਰਾਈਵਰ ਅੱਛਾ ਰੱਖੋ ਕੁਆਲੀਫਾਈਡ ਰੱਖੋ ਪੜ੍ਹਿਆ ਲਿਖਿਆ ਤਾਂ ਕਿ ਉਸਨੂੰ ਅਗਲੇ ਬੰਦੇ ਦੀ ਸਮਝ ਵੀ ਆਏ ਅਸੀਂ ਉਸ ਨੂੰ ਕਈ ਵਾਰੀ ਕਿਹਾ ਕਿ ਹੌਲੀ ਚਲਾ ਹੌਲੀ ਚਲਾ ਪਰ ਉਹ ਆਪਣਾ ਸਾਡੇ ਕਹੇ ਅਨੁਸਾਰ ਇੱਕ ਮਿੰਟ ਵੀ ਨਹੀਂ ਰੁਕਿਆ ਉਹਨੇ ਫਾਸਟ ਗੱਡੀ ਦੌੜਾਣੀ ਦੌੜਾਈ ਗਿਆ ਦੌੜਾਈ ਗਿਆ ਲੇਕਿਨ ਦੇਖੋ ਇਸ ਨਾਲ ਜ਼ਿਆਦਾ ਸਾਡਾ ਐਕਸੀਡੈਂਟ ਹੋ ਜਾਂਦਾ ਤਾਂ ਕੌਣ ਸੀ ਸੀ ਕਿਰਪਾ ਕਰਕੇ ਤੁਸੀਂ ਜਿਹੜਾ ਡਰਾਈਵਰ ਭੇਜਣਾ ਹੁੰਦਾ ਪਲੀਜ਼ ਥੋੜ੍ਹਾ ਜਿਹਾ ਉਹਨੂੰ ਦੇਖਿਆ ਕਰੋ ਕਿ ਉਹ ਸਾਫ ਹੋਵੇ ਤਾਂ ਕਿ ਉਸਦਾ ਨੱਕ ਨਾ ਵੱਗਦਾ ਹੋਵੇ ਉਹ ਕੋਵਿਡ ਦੇ ਕਰਕੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਮਾਕਸ ਪਾਉਣਾ ਜ਼ਰੂਰੀ ਹੈ ਨਾ ਤਾਂ ਉਹਨੇ ਮਾਕਸ ਪਾਇਆ ਸੀ ਉਹਨੂੰ ਮਾਕਸ ਪਾ ਕੇ ਸਾਫ ਸੁਥਰੇ ਕੱਪੜੇ ਪਾ ਕੇ ਅਤੇ ਉਹਨੂੰ ਹਲੀਮੀ ਨਾਲ ਬੋਲਣ ਦੀ ਅਕਲ ਦਵੋ ਤਾਂ ਕਿ ਅਸੀਂ ਅੱਗੋਂ ਤੋਂ ਨਿਰਾਸ਼ ਨਾ ਹੋਈਏ